ਮੈਂ ਬਹੁਤ ਸਮੇਂ ਪਹਿਲਾਂ ਮਿੰਨਤਰਾ ਐਪ ਤੋਂ ਬਹੁਤ ਬਹੁਤ ਸਾਰੇ ਈਅਰਿੰਗਜ਼ ਮੰਗਵਾਏ ਸਨ ਜੋ ਕਿ ਬਹੁਤ ਹੀ ਵਧੀਆ ਕੁਆਲਟੀ ਦੇ ਨਿਕਲੇ ਅਤੇ ਉਹ ਕਲਰਫੁੱਲ ਸੀਗੇ ਉਸ ਤੋਂ ਬਆਦ ਉਹ ਕਾਫੀ ਹੀ ਵਧੀਆ ਸਨ ਅਤੇ ਤੁਸੀਂ ਵੀ ਉਹਨਾਂ ਨੂੰ ਟਰਾਏ ਕਰ ਸਕਦੇ ਹੋ ਬੀਕੋਜ਼ ਮੈਂ ਟਰਾਏ ਕੀਤੇ ਸੀਗੇ ਮੈਨੂੰ ਵੀ ਬਹੁਤ ਵਧੀਆ ਲੱਗੇ ਅਤੇ ਉਹ ਕਾਫ਼ੀ ਲਾਈਟਵੈਟ ਸੀਗੇ ਅਤੇ ਬਹੁਤ ਹੀ ਵਧੀਆ ਵੀ ਲੱਗੇ ਮੈਨੂੰ ਅਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ